ਹੈਲੋ ਸੁਮਿਤ ਯਾਰ ਮੈਨੂੰ ਜੋਤੀ ਬੀਐਡ ਕਾਲਜ ਵਿੱਚੋਂ ਫੋਨ ਆਇਆ ਸੀ ਟੀਚਰ ਦਾ ਅਤੇ ਉਹ ਕਹਿੰਦੇ ਸੀ ਵੀ ਤੂੰ ਆਪਣੇ ਟੈਂਨਥ ਅਤੇ ਟਵੈਲਥ ਕਲਾਸ ਦੀ ਡੀ ਐਮ ਸੀ ਸਾਨੂੰ ਦੇ ਜਾ ਬਟ ਯਾਰ ਮੈਂ ਤਾਂ ਇੱਥੇ ਚੰਡੀਗੜ੍ਹ ਆਇਆ ਹੋਇਆ ਹਾਂ ਪੇਪਰ ਦੇਣ ਅਤੇ ਮੈਂ ਪੋਸੀਬਲ ਨਹੀਂ ਹੈਗਾ ਕਿ ਉਹਨਾਂ ਨੂੰ ਆਪਣੀ ਡੀ ਐਮ ਸੀ ਦੇ ਆਵਾਂ ਤਾਂ ਮੈਂ ਇਵੇਂ ਕਰਦਾ ਕਿ ਤੈਨੂੰ ਵਟਸਐਪ 'ਤੇ ਆਪਣੇ ਡੀਜੀਲੋਕਰ ਦਾ ਯੂਜ਼ਰ ਨੇਮ ਅਤੇ ਪਾਸਵਰਡ ਸੈਂਡ ਕਰ ਦੇਂਦਾ ਹਾਂ ਉਹਦੇ ਨਾਲ ਤੂੰ ਕੀ ਕਰੀਂ ਆਪਣਾ ਪ੍ਰਿੰਟ ਆਊਟ ਕਢਵਾ ਲਈਂ ਮੇਰੀ ਟੈਂਨਥ ਦੀ ਅਤੇ ਪਲੱਸ ਟੂ ਦੀ ਡੀ ਐਮ ਸੀ ਦਾ ਅਤੇ ਟੀਚਰ ਨੂੰ ਦੇ ਆਈਂ ਉਹਦੇ ਨਾਲ ਕੀ ਹੋਵੇਗਾ ਵੀ ਉਹ ਆ ਅੱਗੇ ਦੀ ਕਾਰਵਾਈ ਪੂਰੀ ਕਰ ਸਕਣਗੇ ਕਿਉਂਕਿ ਮੈਂ ਤਾਂ ਤੈਨੂੰ ਪਤਾ ਆ ਨਹੀਂ ਸਕਦਾ ਚੰਡੀਗੜ੍ਹ ਤੋਂ ਸਿੱਧਾ ਕੋਲੇਜ ਕਿ ਡਾਕੂਮੈਂਟਸ ਘਰ ਪਏ ਨੇ ਜਿਵੇਂ ਵੀ ਹੈ ਅਤੇ ਇਹ ਘਰ ਤਾਲਾ ਲੱਗਿਆ ਹੋਇਆ ਅਤੇ ਤਾਲੇ ਦੀ ਚਾਬੀ ਮੇਰੇ ਕੋਲ ਹੈ ਤੇ ਤੂੰ ਹੈਂ ਹੀ ਕਰ ਡੀਜੀਲੋਕਰ ਤੋਂ ਕਢਵਾ ਕੇ ਡਾਕੂਮੈਂਟਸ ਮੈਡਮ ਨੂੰ ਸਬਮਿਟ ਕਰਵਾ ਦੇ ਠੀਕ ਹੈ ਤਾਂ ਜੋ ਵੀ ਹੋਵੇਗਾ ਕਾਰਵਾਈ ਜਿਵੇਂ ਵੀ ਹੈ ਤੈਨੂੰ ਕਿਸੇ ਗੱਲ ਦੀ ਦਿੱਕਤ ਆਵੇ ਤਾਂ ਤੂੰ ਮੈਨੂੰ ਫੋਨ ਕਰ ਲਈਂ ਤੂੰ ਇਵੇਂ ਕਰ ਕਿਸੇ ਵੀ ਫ਼ਾਜ਼ਿਲਕਾ ਦੇ ਆਨਲਾਈਨ ਪੁਆਇੰਟ 'ਤੇ ਚਲਾ ਜਾ ਅਤੇ ਉਹਨਾਂ ਨੂੰ ਕਹਿ ਵੀ ਵੀਰੇ ਆਹ ਜਿਹੜੀ ਦੋ ਡੀ ਐਮ ਸੀ ਆਂ ਨੇ ਇਹਨਾਂ ਦਾ ਪ੍ਰਿੰਟ ਆਊਟ ਕੱਢਨਾ ਹੈ ਤੇ ਮੈਂ ਇਵੇਂ ਕਰਨਾ ਜਿਹੜਾ ਵਟਸਐਪ ਤੇਰਾ ਚਲਦਾ ਹੋਵੇਗਾ ਜੋ ਵੀ ਹੈ ਇਹਦੇ 'ਤੇ ਮੈਂ ਤੈਨੂੰ ਆਪਣਾ ਯੂਜਰ ਨੇਮ ਅਤੇ ਪਾਸਵਰਡ ਡੀਜੀਲੋਕਰ ਦਾ ਸੈਂਡ ਕਰ ਦੇਂਦਾ ਹਾਂ ਅਤੇ ਉਸ ਤੋਂ ਬਾਅਦ ਕਢਾ ਕੇ ਨਾ ਤੂੰ ਮੈਨੂੰ ਦੱਸ ਦੇਈਂ ਅਤੇ ਇਹ ਯੂਜ਼ਰ ਨੇਮ ਅਤੇ ਪਾਸਵਰਡ ਉਹਨੂੰ ਸ਼ੋਪਕੀਪਰ ਨੂੰ ਨਾ ਦੱਸੀ ਕੀ ਪਤਾ ਉਹ ਕੱਲ੍ਹ ਨੂੰ ਆਪਣੀ ਡੀ ਐਮ ਸੀ ਆਂ ਦਾ ਮਿਸ ਯੂਜ ਕਰੇ ਜਾਂ ਜੋ ਵੀ ਆਧਾਰ ਕਾਰਡ ਦਾ ਕਰੇ ਡਰਾਈਵਿੰਗ ਲਾਈਸੈਂਸ ਵੱਟਐਵਰ ਵੀ ਕੈਂਨ ਸੇ ਤਾਂ ਤੂੰ ਥੋੜ੍ਹਾ ਜਿਹਾ ਧਿਆਨ ਰੱਖੀਂ ਸਕਿਉਰਟੀ ਦਾ ਠੀਕ ਹੈ ਬਰਦਰ ਓਕੇ ਵੀਰੇ ਬਾਏ